ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਸਾਨੂੰ ਕਿਹੜੀਆਂ ਤਕਨੀਕਾਂ ਅਤੇ ਟਾਂਕਿਆਂ ਨਾਲ ਕੰਮ ਕਰਨਾ ਚੁਣੌਤੀ ਪੂਰਵਕ ਲੱਗਦਾ ਹੈ ਸਾਨੂੰ ਇਹ ਕੋਈ ਚੁਣੌਤੀਪੂਰਨ ਨਹੀਂ ਲੱਗਦਾ ਕਿਉਂਕਿ ਅਸੀਂ ਇਹਨਾਂ ਨੂੰ ਬੜੇ ਹੀ ਚੰਗੇ ਢੰਗ ਨਾਲ ਸਿੱਖਿਆ ਹੋਇਆ ਹੈ ਜੇਕਰ ਅਸੀਂ ਗੱਲ ਕਰੀਏ ਟਾਂਕਿਆਂ ਦੀ ਤਾਂ ਸਾਡੀ ਕਢਾਈ ਵਿੱਚ ਕੁੱਲ ਸਤਾਰ੍ਹਾਂ ਕੁੱਲ ਪੰਤਾਲੀ ਟਾਂਕੇ ਹੁੰਦੇ ਹਨ ਸਤਾਰ੍ਹਾਂ ਤੋਂ ਪੰਤਾਲੀ ਟਾਂਕੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਸਾਨੂੰ ਕੁਝ ਟਾਂਕੇ ਨਾਂ ਯਾਦ ਹਨ ਜਿਨ੍ਹਾਂ ਇਸ ਇਹਨਾਂ ਦੇ ਨਾਂ ਹਨ ਸਿੰਧੀ ਟਾਂਕਾ ਕਸ਼ਮੀਰੀ ਟਾਂਕਾ ਲੇਜੀ ਟੇਜੀ ਚੈਂਨ ਟਾਂਕਾ ਅਤੇ ਭਰਮਾ ਟਾਂਕਾ ਅਤੇ ਕੁਝ ਹੋਰ ਵੀ ਨਾਂ ਯਾ ਹਨ ਇਹਨਾਂ ਟਾਂਕਿਆਂ ਵਿੱਚੋਂ ਸਾਨੂੰ ਸਿੰਧੀ ਟਾਂਕਾ ਬਹੁਤ ਹੀ ਅੱਛਾ ਲੱਗਦਾ ਹੈ ਹੈ ਤਾਂ ਉਹ ਔਖਾ ਹੈ ਪਰ ਲੇਕਿਨ ਸਾਨੂੰ ਇੰਨੀ ਚੰਗੀ ਤਰ੍ਹਾਂ ਨਾਲ ਸਮਝਾਇਆ ਹੈ ਕਿ ਸਾਨੂੰ ਉਹ ਕੱਢਣ 'ਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਅਸੀਂ ਸਿੰਧੀ ਟਾਂਕੇ ਦੇ ਕਾਫੀ ਸੂਟ ਵਗੈਰਾ ਕੱਢੇ ਹਨ ਜਿਹੜੇ ਅਸੀਂ ਆਪਣੇ ਪਾਉਂਦੇ ਹਾਂ ਅਤੇ ਸਾਨੂੰ ਬਹੁਤ ਹੀ ਚੰਗੇ ਲੱਗਦੇ ਹਨ ਤੁਹਾਡਾ ਸਾਨੂੰ ਇਹ ਸਭ ਤੋਂ ਔਖਾ ਪਹਿਰਾਵਾ ਤਾਂ ਕੋਈ ਵੀ ਨਹੀਂ ਲੱਗਦਾ ਪਰ ਦੇਖੋ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਪ ਪਹਿਰਾਵੇ ਦੀ ਤਾਂ ਸਾਡੇ ਸਾਰਾ ਲਿਬਾਸ ਜਿਹੜੇ ਆ ਉਹ ਬਹੁਤ ਹੀ ਸੌਖੇ ਹਨ ਪਰ ਹਾਂ ਕੁਛ ਲਿਬਾਸਾਂ ਨੂੰ ਬਣਾਉਣ ਦਾ ਸਮਾਂ ਤਾਂ ਲੱਗਦਾ ਹੈ ਲੇਕਿਨ ਅਸੀਂ ਬੜੇ ਹੀ ਚੰਗੇ ਤਰੀਕੇ ਨਾਲ ਉਹਨਾਂ ਨੂੰ ਬਣਾ ਸਕਦੇ ਹਾਂ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਟਾਂਕਿਆਂ ਹੱਥਾਂ ਦੇ ਕਾਰਨ ਟਾਂਕੇ ਅਸੀਂ ਕਿੱਦਾਂ ਬਣਾਉਂਦੇ ਹਾਂ ਤਾਂ ਹੱਥ ਦਾ ਕੰਮ ਕਰਨ ਨਾਲ ਟਾਈਮ ਤਾਂ ਲੱਗਦਾ ਹੀ ਹੈ ਜੇਕਰ ਅਸੀਂ ਮਸ਼ੀਨ ਨਾਲ ਉਹ ਕੰਮ ਕਰਦੇ ਹਾਂ ਪਰ ਉਹ ਕੰਮ ਜਿਹੜਾ ਮਸ਼ੀਨ ਨਾਲ ਕਰਦੇ ਹਾਂ ਅਤੇ ਹੱਥ ਦੇ ਕੰਮ ਦਾ ਬੜਾ ਹੀ ਫਰਕ ਹੈ ਹੱਥ ਨਾਲ ਕੀਤਾ ਹੋਇਆ ਕੰਮ ਜਿਹੜਾ ਆ ਉਹ ਹੁੰਦਾ ਤਾਂ ਟਾਈਮ ਲੱਗ ਗਿਆ ਲੇਕਿਨ ਉਹ ਜ਼ਿਆਦਾ ਅੱਛਾ ਲੱਗਦਾ ਹੈ ਅਤੇ ਜਿਹੜਾ ਮਸ਼ੀਨੀ ਕੰਮ ਹੈ ਉਹਨੂੰ ਜਿਹੜਾ ਜ਼ਿਆਦਾ ਘੱਟ ਸਮਾਂ ਲੱਗਦਾ ਹੈ ਅਤੇ ਅਸੀਂ ਜਿਹੜਾ ਤੁਸੀਂ ਪੁੱਛਿਆ ਹੈ ਕਿ ਪਹਿਰਾਵਾ ਅਤੇ ਪਹਿਰਾਵਾ ਸਾਨੂੰ ਕੋਈ ਵੀ ਔਖਾ ਨਹੀਂ ਲੱਗਦਾ ਅਤੇ ਸਮਾਂ ਤਾਂ ਇਹਨੂੰ ਲੱਗਦਾ ਹੈ ਲੇਕਿਨ ਅਸੀਂ ਫਿਰ ਵੀ ਬਣਾ ਲੈਂਦੇ ਹਾਂ ਬੜੇ ਚੰਗੇ ਤਰੀਕੇ ਨਾਲ ਅਸੀਂ ਸਾਰੇ ਪਹਿਰਾਵੇ ਬਣਾਉਂਦੇ ਹਾਂ ਜਿਨ੍ਹਾਂ ਵਿੱਚੋਂ ਸੂਟ ਲਹਿੰਗੇ ਚੋਲੀ ਜਾਂ ਸਾੜੀਆਂ ਬਲਾਊਜ਼ ਸਭ ਕੁਝ ਅਸੀਂ ਬਣਾ ਲੈਂਦੇ ਹਾਂ ਇਹਨਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਟਾਈਮ ਜ਼ਿਆਦਾ ਲੱਗਦਾ ਹੈ ਲੇਕਿਨ ਫਿਰ ਵੀ ਅੱਛੇ ਢੰਗ ਨਾਲ ਬਣ ਜਾਂਦੇ ਹਨ